ਪਿੱਛੇ ਜੇ ਮੰਗਲ ਗ੍ਰਹਿ ਦੇ ਉੱਪਰ ਇੱਕ ਮੰਗਲਯਾਨ ਭੇਜਿਆ ਸੀਗਾ ਜਿਸਦੇ ਅਕੋਡਿੰਗ ਸਾਨੂੰ ਵਿਗਿਆਨੀਆਂ ਨੇ ਦੱਸਿਆ ਵੀ ਪਾਣੀ ਅਤੇ ਆਕਸੀਜਨ ਦੀ ਉੱਥੇ ਵੈਲਿਊ ਬਹੁਤ ਜ਼ਿਆਦਾ ਉੱਥੇ ਜਿਹੜਾ ਆਮ ਜੀਵਨ ਹੈ ਉਹ ਸੌਖਾ ਕੱਟਿਆ ਜਾ ਸਕਦਾ